ਪੰਜਾਬ ਵਿੱਚ ਵਪਾਰਕ ਅਤੇ ਭਾਈਚਾਰੇ ਦਾ ਸੰਬੰਧ ਇਹ ਹੈ ਕਿ ਜਿਵੇਂ ਕਿਸਾਨ ਆਪਣੇ ਖੇਤਾਂ 'ਚ ਕਣਕ ਉਗਾਉਂਦਾ ਹੈ ਕਿਸਾਨ ਸਬਜ਼ੀਆਂ ਉਗਾਉਂਦਾ ਹੈ ਉਹ ਜਾ ਕੇ ਵਪਾਰੀਆਂ ਮ ਮੰਡੀਆਂ 'ਚ ਗੇਰਦੇ ਹਨ ਮੰਡੀਆਂ ਦੇ ਉ ਉਹ ਉਨ੍ਹਾਂ ਦੇ ਨਾਲ ਰਿਸ਼ਤਾ ਇਸ ਕਰਕੇ ਚੰਗਾ ਬਣਿਆ ਹੋਇਆ ਕਿਉਂਕਿ ਕਿਸਾਨ ਤਾਂ ਸਬਜ਼ੀ ਬਣਾ ਕੇ ਪੈਦਾ ਕਰਦਾ ਹੈ ਖੇਤਾਂ 'ਚ ਲਗਾਉਂਦਾ ਹੈ ਅਤੇ ਵਪਾਰੀ ਉਹਨਾਂ ਨੂੰ ਉਹਨਾਂ ਤੋਂ ਖਰੀਦ ਕੇ ਉਹਨਾਂ ਤੋਂ ਅੱਗੇ ਵੇਚਦਾ ਹੈ ਵੇਚ ਕੇ ਅੱਗੇ ਛੋਟੇ ਦੁਕਾਨਦਾਰ ਅੱਗੇ ਭਾਈਚਾਰੇ 'ਚ ਪਿੰਡਾਂ 'ਚ ਲਿਜਾ ਕੇ ਉਹਨਾਂ ਨੂੰ ਵੇਚਦੇ ਹਨ ਜਿਸ ਕਰਕੇ ਭਾਈਚਾਰੇ ਦਾ ਕੰਮ ਇਹ ਬਹੁਤ ਚੰਗਾ ਚੱਲ ਰਿਹਾ ਹੈ ਜਿਸ ਕਰਕੇ ਸਾਨੂੰ ਆਪਸ 'ਚ ਮਿਲ ਕੇ ਸਾਰੇ ਕੰਮ ਕਰਨੇ ਪੈ ਰਹੇ ਹਨ